ਨੌਂ ਮਾਰਚ ਦੋ ਹਜ਼ਾਰ ਤਿੰਨ ਚੌਦ੍ਹਾਂ ਨਵੰਬਰ ਉੱਨੀ ਸੌ ਪੰਝੱਤਰ ਬਾਰਾਂ ਜਨਵਰੀ ਉੱਨੀ ਸੌ ਅੱਸੀ ਪੱਚੀ ਦਸੰਬਰ ਦੋ ਹਜ਼ਾਰ ਤਿੰਨ ਸਤਾਈ ਅਗਸਤ ਦੋ ਹਜ਼ਾਰ ਸੱਤ